ਜੇ ਗੱਲ ਕਰੀਏ ਅਸੀਂ ਭਾਰਤ ਦੀ ਜਾਂ ਅਸੀਂ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਥੇ ਬਹੁਤ ਸਾਰੇ ਅਜਿਹੇ ਸੂਰਬੀਰ ਹੋਏ ਨੇ ਜਿਹਨਾਂ ਨੇ ਸਾਡੀ ਧਰਤੀ ਨੂੰ ਬਚਾਅ ਕੇ ਰੱਖਿਆ ਇਸ ਨੂੰ ਰੋਕ ਦਿੱਤਾ ਅਤੇ ਸਾਡੇ ਸੱਭਿਆਚਾਰ ਨੂੰ ਬਚਾਅ ਕੇ ਰੱਖਿਆ ਗੱਲ ਕਰੀਏ ਭਾਰਤ ਸ਼ੁਰੂ ਤੋਂ ਹੀ ਸੂਰਵੀਰਾਂ ਦੀ ਜਾਂ ਮਹਾਨ ਸ਼ਖਸ਼ੀਅਤਾਂ ਦੀ ਧਰਤੀ ਰਹੀ ਹੈ ਇੱਥੇ ਕਾਫੀ ਸਾਰੇ ਮਹਾਨ ਲੋਕੀ ਹੋਏ ਨੇ ਜਿਹਨਾਂ ਨੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਅੱਜ ਦੇ ਟਾਈਮ 'ਚ ਹਰ ਕੋਈ ਬੰਦਾ ਇਹਨਾਂ ਸਾਰਿਆਂ ਤੋਂ ਪ੍ਰੇਰਿਤ ਹੈ ਜਿੱਥੇ ਜੇ ਅਸੀਂ ਗੱਲ ਕਰੀਏ ਸ਼ਹੀਦਾਂ ਦੀ ਰਾਜਗੁਰੂ ਸੁਖਦੇਵ ਭਗਤ ਸਿੰਘ ਇਹਨਾਂ ਕਰਕੇ ਸਾਰੇ ਕਾਫੀ ਸਾਰੇ ਲੋਕ ਆਪਣੇ ਆਪ ਤੋਂ ਪ੍ਰੇਰਿਤ ਹੋਏ ਨੇ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਸਾਰੇ ਲੋਕ ਇਹਨਾਂ ਤੋਂ ਹੀ ਪ੍ਰੇਰਿਤ ਹੋ ਗਏ ਅਜਿਹੇ ਕੰਮ ਵੀ ਕਰਦੇ ਨੇ ਜੋ ਕਾਫੀ ਸਾਰੇ ਲੋਕ ਨਹੀਂ ਕਰਦੇ ਕਾਫੀ ਸਾਰੇ ਲੋਕ ਆਪਣੇ ਮਨੋਭਾਵਨਾ ਸੇਵਾ ਵੀ ਕਰਦੇ ਨੇ ਕਾਫੀ ਸਾਰੇ ਲੋਕ ਤਾਂ ਆਪਣੇ ਦੇਸ਼ ਭਗਤੀ ਵੀ ਬਹੁਤ ਜ਼ਿਆਦਾ ਕਰਦੇ ਨੇ ਜੋ ਕਾਫੀ ਸਾਰੇ ਆਪਣੇ ਦੇਸ਼ ਨੂੰ ਵੀ ਜ਼ਿਆਦਾ ਮੰਨਦੇ ਨੇ ਸ਼ੁਰੂ ਦੇ ਵਿੱਚ ਅਸੀਂ ਗੱਲ ਕਰੀਏ ਸਾਡਾ ਸੱਭਿਆਚਾਰ ਵੀ ਇਹਨਾਂ ਦੇ ਕਰਕੇ ਕਿਤੇ ਬਚਿਆ ਹੋਇਆ ਹੈ ਸਾਡਾ ਸੱਭਿਆਚਾਰ ਹਮੇਸ਼ਾਂ ਤੋਂ ਇੱਕ ਸਹੀ ਰੂਪ ਦਾ ਰਿਹਾ ਹੈ ਗੱਲ ਕਰੀਏ ਤਾਂ ਸਾਫ ਸੁਥਰਾ ਅਤੇ ਸੋਹਣਾ ਅਤੇ ਇੱਕ ਚੰਗਾ ਸਾਡਾ ਸੱਭਿਆਚਾਰ ਰਿਹਾ ਹੈ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਕਰਕੇ ਕਹਿ ਸਕਦੇ ਹਾਂ ਕਿ ਨੇਤਾਵਾਂ ਸ਼ਹੀਦਾਂ ਜਾਂ ਸਾਡੇ ਹੋਰ ਵੀ ਕਾਫੀ ਸਾਰੇ ਸ਼ਖਸ਼ੀਅਤਾਂ ਨੇ ਜਾਂ ਕਲਾਕਾਰ ਨੇ ਜਿਹਨਾਂ ਕਰਕੇ ਸੱਭਿਆਚਾਰ ਬਚਿਆ ਹੋਇਆ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਬਹੁਤ ਚੰਗਾ ਰਿਹਾ ਹੈ ਇਹਨਾਂ ਸ਼ਹੀਦਾਂ ਸੂਰਵੀਰਾਂ ਕਰਕੇ ਕਾਫੀ ਸਾਰੇ ਅਜਿਹੇ ਮਹਾਨ ਸ਼ਖਸ਼ੀਅਤਾਂ ਨੇ ਵੀ ਆਪਣਾ ਯੋਗ ਦੇ ਯੋਗਦਾਨ ਦਿੱਤਾ ਹੈ ਇਸ ਧਰਤੀ ਦੇ ਉੱਤੇ ਸੱਭਿਆਚਾਰ ਨੂੰ ਬਚਾਉਣ ਲਈ ਜਾਂ ਇਸ ਸੱਭਿਆਚਾਰ ਨੂੰ ਰੂਪ ਦੇਣ ਲਈ